ਹੈਲੋ ਹਾਂਜੀ ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਮੈਮ ਬਿਲਕੁਲ ਮੈਡਮ ਅਸੀਂ ਇੰਟੀਰੀਅਰ ਡਿਜਾਈਨਿੰਗ 'ਚ ਕੰਟੀ ਕਿਚਨ ਇੰਟੀਰੀਅਰ ਬਾਥਰੂਮ ਰੈਨੋਵੇਸ਼ਨ ਹੈ ਨਾ ਤੁਸੀਂ ਚਾਹੇ ਨਿਊ ਕੰਸਟਰਕਸ਼ਨ ਸਾ ਦੇ ਅੰਦਰ ਸਾਰੀ ਇੰਟੀਰੀਅਰ ਕਰਦੇ ਹਾਂ ਅੱਛਾ ਜੀ ਅੱਛਾ ਜੀ ਮੈਡਮ ਦੇਖੋ ਵੁੱਡਵਰਕ ਦੇ ਚਾਰਜਿਸ ਅਲੱਗ ਨੇ ਅਤੇ ਇਹ ਅਸੀਂ ਜਿਵੇਂ ਕੰਮ ਦੇ ਉੱਤੇ ਡਿਪੈਂਡ ਕਰਦਾ ਤੁਹਾਡੇ ਕੋਲ ਕਿੰਨਾ ਤੁਹਾਡਾ ਕਿੰਨਾ ਸਕੇਅਰ ਫੀਟ ਕੰਮ ਬਣਦਾ ਹੈ ਨਾ ਅਤੇ ਉਹਦੇ 'ਤੇ ਵੁੱਡ ਵਰਕ ਦਾ ਅਸੀਂ ਕੌਟਰੈਕਟ ਵੀ ਲੈਂਦੇ ਹਾਂ ਜੇ ਤੁਸੀਂ ਜ਼ਿਆਦਾ ਕੰਮ ਹੋਵੇ ਜੇ ਤੁਹਾਡਾ ਇਨ ਕੇਸ ਕੰਮ ਘੱਟ ਹੈ ਤਾਂ ਫਿਰ ਮੈਡਮ ਅਸੀਂ ਡੇਲੀ ਵੇਜਸ 'ਤੇ ਵੀ ਕਰ ਦਿੰਦੇ ਆ ਅਸੀਂ ਆਪਣਾ ਕਾਰਪੇਂਟਰ ਹੈ ਆਪਣੀ ਲੇਬਰ ਭੇਜਦੇ ਹਾਂ ਨਾਲ ਸੁਪਰਵਾਈਜ਼ਰ ਭੇਜਦੇ ਹਾਂ ਉਹ ਤੁਹਾਡਾ ਸਾਰਾ ਕੰਮ ਕਰੂ ਚੈੱਕ ਕਰੂਗਾ ਅਤੇ ਉਸ ਬੇਸ 'ਤੇ ਫਿਰ ਅਸੀਂ ਚਾਰਜਿਸ ਕਰਦੇ ਹਾਂ ਮੈਡਮ ਉਹ ਤੁਹਾਡੀ ਮਰਜ਼ੀ ਆ ਦੇਖੋ ਜੇ ਤਾਂ ਤੁਸੀਂ ਕਈ ਵਾਰੀ ਘੱਟ ਟਾਈਮ ਹੁੰਦਾ ਤਾਂ ਬੰਦਾ ਕਹਿ ਦਿੰਦਾ ਤੁਸੀਂ ਆਪ ਏ ਕਰ ਦਿਉ ਅਸੀਂ ਆਪ ਸਮਾਨ ਖਰੀਦ ਲਵਾਂਗੇ ਪਰ ਜੇ ਤੁਸੀਂ ਆਪ ਵੀਲਿੰਗ ਹੈ ਦੇਣ 'ਚ ਤਾਂ ਸਾਨੂੰ ਕੋਈ ਨਹੀਂ ਤੁਸੀਂ ਸਮਾਨ ਲਿਆ ਕੇ ਸਾਨੂੰ ਪ੍ਰੋਵਾਈਡ ਕਰ ਦਿਉ ਸਾਡੇ ਬੰਦੇ ਬਣਾ ਦੇਣਗੇ ਉਹ ਡਿਜ਼ਾਈਨ ਠੀਕ ਹੈ ਹਾਂਜੀ ਮੈਡਮ ਇਹਦੇ 'ਚ ਮੈਡਮ ਕੀ ਹੋਊਗਾ ਕਿ ਕੰਮ ਅਸੀਂ ਨਾਲ ਸੁਪਰਵਾਈਜ਼ਰ ਭੇਜਾਂਗੇ ਉਹ ਤੁਹਾਡਾ ਚੈੱਕ ਕਰੂਗਾ ਪਰ ਇਹਦੇ 'ਚ ਪਹਿਲਾਂ ਕੀ ਆ ਤੁਹਾਨੂੰ ਤੁਸੀਂ ਔਫਿਸ ਆਓ ਸਾਡੇ ਔਫਿਸ ਆ ਕੇ ਪਹਿਲਾਂ ਡਿਜ਼ਾਈਨ ਪਸੰਦ ਕਰੋ ਡਿਜਾਇਨ ਪਸੰਦ ਕਰ ਲਓ ਫਿਰ ਉਸ ਬੇਸ 'ਤੇ ਤੁਹਾਡਾ ਅਸੀਂ ਕਰ ਦੇਵਾਂਗੇ ਤੁਸੀਂ ਵਿਜਿਟ ਕਰੋ ਔਫਿਸ ਜੀ ਤੁਸੀਂ ਕੱਲ੍ਹ ਆ ਜਾਓ ਜੀ ਕੱਲ੍ਹ ਕਿਸੇ ਵੀ ਟਾਈਮ ਆ ਜਾਓ ਜੀ ਹਾਂਜੀ ਹਾਂਜੀ ਮੈਡਮ ਹਾਂਜੀ ਹਾਂਜੀ ਹਾਂਜੀ ਤੁਹਾਨੂੰ ਸਾਰੀ ਡਿਟੇਲ ਦੱਸ ਦੇਵਾਂਗੇ ਠੀਕ ਹੈ ਮੈਡਮ ਠੀਕ ਹੈ ਜੀ ਓਕੇ ਜੀ ਓਕੇ ਓਕੇ